ਇਹ ਸੱਚ ਹੈ ਲੋਕਾਂ ਦੇ ਜੀਵਨ ਦੀ ਸਮੁੱਚੀ ਗੁਣਵੰਤਾ ਪੌਜ਼ਟਿਵ ਪ੍ਰਭਾਵ ਪਾ ਸਕਦੀ ਹੈ ਕਿਉਂਕਿ ਬੱਚੇ ਕੋਰਾ ਕਾਗਜ਼ ਹੈ ਅਤੇ ਮਾਂ ਪਿਓ ਪਿੰਡ ਦਾ ਸਰਪੰਚ ਪਿੰਡ ਦੇ ਸੁਧਾਰ ਵਾਸਤੇ ਬੱਚਿਆਂ ਨੂੰ ਗਰਾਊਂਡ ਦੇਵੇ ਗਰਾਊਂਡ ਦੇ ਵਿੱਚ ਕੁਛ ਸਮਾਨ ਮੁਹੱਈਆ ਕਰਵਾਵੇ ਜਿਵੇਂ ਫੁੱਟਬਾਲ ਹਾਕੀ ਬਾਲ ਜਿਹਦੇ ਨਾਲ ਬੱਚਿਆਂ ਨੂੰ ਇਹਦਾ ਇੱਧਰ ਖਿੱਚ ਬਣੇ ਕਿ ਅਸੀਂ ਖੇਡਾਂਗੇ ਅਤੇ ਅੱਗੇ ਆਉਣ ਵਾਲੀ ਜੀਵਨ ਦੇ ਵਿੱਚ ਕੁਛ ਬਣਾਗੇ ਅਤੇ ਸਰੀਰ ਦੀ ਤੰਦਰੁਸਤੀ ਇਹਦੇ ਨਾਲ ਬਣੀ ਰਹੂਗੀ ਸਰੀਰ ਦੀ ਤੰਦਰੁਸਤੀ ਵਾਸਤੇ ਵੀ ਖੇਡਣਾ ਜ਼ਰੂਰੀ ਆ ਅਤੇ ਇਹਦੇ ਨਾਲ ਲੋਕ ਨਸ਼ੇ ਤੋਂ ਬਚੇ ਰਹਿਣਗੇ ਲੜਾਈ ਝਗੜੇ ਤੋਂ ਬਚੇ ਰਹਿਣਗੇ ਲੋਕ ਗਰਾਊਂਡ ਦੇ ਵਿੱਚ ਮਿਲ ਕੇ ਬਹਿਣਗੇ ਚੰਗੇ ਖਿਡਾਰੀਆਂ ਦੀਆਂ ਗੱਲਾਂ ਕਰਨਗੇ ਜਿਹੜੇ ਕਿ ਪਹਿਲਾਂ ਨਾਮ ਨਾ ਖੱਟ ਚੁੱਕੇ ਆ ਵਰਲਡ ਕੱਪ 'ਚ ਜਾ ਚੁੱਕੇ ਆ ਉਲੰਪਿਕ 'ਚ ਜਾ ਚੁੱਕੇ ਆ ਅਤੇ ਬੱਚਿਆਂ 'ਤੇ ਚੰਗਾ ਪ੍ਰਭਾਵ ਪਊਗਾ ਚੰਗਾ ਪ੍ਰਭਾਵ ਪਊਗਾ ਅਤੇ ਬੱਚੇ ਚੰਗੀ ਸੋਚ ਦੇ ਮਾਲਕ ਹੋਣਗੇ ਚੰਗੇ ਸਰੀਰ ਦੇ ਮਾਲਕ ਹੋਣਗੇ ਅਤੇ ਖੇਡਾਂ ਵਿੱਚ ਉਹ ਵੀ ਆਪਣਾ ਨਾਂ ਕਮਾਉਣਗੇ ਅਤੇ ਆਪਣੇ ਮਾਂ ਪਿਓ ਦਾ ਨਾਮ ਬਣੂਗਾ ਮਾਂ ਪਿਓ ਦਾ ਨਾਮ ਬਣੂਗਾ ਤਾਂ ਪਿੰਡ ਦਾ ਨਾਮ ਬਣੂਗਾ ਪਿੰਡ ਦਾ ਨਾਮ ਬਣੂਗਾ ਤਾਂ ਦੇਸ਼ ਦਾ ਨਾਮ ਬਣੂਗਾ